ਮੇਰੇ ਘਰ ਵਿੱਚ ਇੱਕ ਛੋਟਾ ਜਿਹਾ ਬਗ਼ੀਚਾ ਹੈ ਜਿਹਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਮੈਂ ਪੌਦੇ ਲਗਾਏ ਹਨ ਜਿਵੇਂ ਕਿ ਫੁੱਲਾਂ ਦੇ ਗੇਂਦੇ ਦਾ ਗੁਲਾਬ ਦਾ ਦੁਪਹਿਰ ਖਿੜ੍ਹੀ ਅਤੇ ਹੋਰ ਵੀ ਬਹੁਤ ਸਾਰੇ ਹਨ ਅਤੇ ਕੁਛ ਪੌਦੇ ਮੇਰੇ ਘਰ ਦੇ ਬਗ਼ੀਚੇ ਵਿੱਚ ਐਵੇਂ ਦੇ ਲੱਗੇ ਹੋਏ ਹਨ ਜਿਹੜੇ ਕਿ ਸਾਡੇ ਆਯੂਰਵੇਦਿਕ ਵਿੱਚ ਕੰਮ ਆਉਂਦੇ ਹਨ ਜਿਵੇਂ ਕਿ ਦਵਾਈਆਂ ਬਣਾਉਣ ਦੇ ਜਿਵੇਂ ਤੁਲਸੀ ਹੋ ਗਈ ਪੱਥਰਚੱਟ ਹੋ ਗਿਆ ਅਤੇ ਅਜਵਾਇਣ ਹੋ ਗਈ ਇਹ ਸਾਰੇ ਜਿਹੜੇ ਪੌਦੇ ਹਨ ਇਹ ਬਹੁਤ ਹੀ ਵਧੀਆ ਹਨ ਅਤੇ ਇਹ ਸਾਡੇ ਦਵਾਈਆਂ ਬਣਾਉਣ ਦੇ ਵੀ ਕੰਮ ਆਉਂਦੇ ਹਨ ਅਤੇ ਨਾਲ਼ ਹੀ ਜਿਹੜੇ ਸਜਾਵਟ ਦੇ ਜਿਵੇਂ ਆਪਾਂ ਕਹਿ ਸਕਦੇ ਹਾਂ ਜਿਵੇਂ ਕਿ ਮਨੀ ਪਲਾਂਟ ਹੋ ਗਿਆ ਸੁੱਖ ਸ਼ਾਂਤੀ ਹੋ ਗਿਆ ਅਤੇ ਹੋਰ ਵੀ ਬਹੁਤ ਸਾਰੇ ਅਤੇ ਕੁਛ ਕੁ ਸਬਜ਼ੀਆਂ ਵੀ ਲਗਾਈਆਂ ਹੋਈਆਂ ਹਨ ਜੋ ਕਿ ਸਾਡੇ ਘਰ ਦੀਆਂ ਆਪਣੀ ਬਹੁਤ ਹੀ ਸਾਡੇ ਘਰ ਦੇ ਗੁਜ਼ਾਰੇ ਜੋਗੀਆਂ ਸਬਜ਼ੀਆਂ ਉਸ ਪੌਦੇ ਤੋਂ ਸਾਨੂੰ ਮਿਲ ਜਾਂਦੀਆਂ ਹਨ ਜਿਵੇਂ ਕਰੇਲੇ ਭਿੰਡੀ ਤੋਰੀ ਦੀ ਘੀਆ ਟਮਾਟਰ ਇਹ ਵੱਖ ਵੱਖ ਸਬਜ਼ੀਆਂ ਹਨ ਜਿਹੜੀਆਂ ਕਿ ਅਸੀਂ ਆਪਣੇ ਬਗ਼ੀਚੇ ਵਿੱਚ ਲਗਾਈਆਂ ਹੋਈਆਂ ਹਨ